ਮੈਂ ਆਪਣੀ ਜ਼ਿੰਦਗੀ ਵਿੱਚ ਮਿਲਣ ਵਾਲੀ ਖੁਸ਼ੀ ਦੇ ਅਹਿਸਾਸ ਨੂੰ ਆਪ ਨਾਲ ਸਾਂਝਾ ਕਰਦਾ ਹਾਂ ਜਦੋਂ ਵੀ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਹਨ ਮੈਂ ਆਪਣੇ ਬੱਚੇ ਅਤੇ ਧਰਮ ਪਤਨੀ ਨਾਲ ਕਿਤੇ ਚੰਗੀ ਹਿਲ ਸਟੇਸ਼ਨ 'ਤੇ ਜਾਣ ਦਾ ਇਰਾਦਾ ਕਰਦੇ ਹਾਂ ਉਸ ਥਾਂ 'ਤੇ ਚੰਗੇ ਹੋਟਲ ਅਤੇ ਚੰਗੇ ਖਾਣੇ ਦਾ ਆਨੰਦ ਮਾਣਦੇ ਹਾਂ ਅਤੇ ਉਸ ਥਾਂ 'ਤੇ ਬੈਠ ਕੇ ਅਸੀਂ ਉਹ ਪਲੇਸ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਚੰਗੀਆਂ ਉਹ ਭੋਜਨ ਚੰਗੇ ਉੱਥੋਂ ਦੇ ਨੇਚਰ ਨੂੰ ਦੇਖ ਕੇ ਆਪਾਂ ਬਹੁਤ ਖੁਸ਼ ਹੁੰਦੇ ਹਾਂ ਅਤੇ ਉੱਥੋਂ ਦੇ ਵਧੀਆ ਵਾਤਾਵਰਨ ਵਿੱਚ ਅਸੀਂ ਸਵੇਰ ਦੀ ਸੈਰ ਅਤੇ ਉੱਥੋਂ ਦਾ ਲੋਕਾਂ ਦਾ ਕਲਚਰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਅਤੇ ਨਾਲ ਹੀ ਅਸੀਂ ਜਦੋਂ ਆਪਣੀ ਫੈਮਲੀ ਨਾਲ ਕਿਤੇ ਚੰਗੇ ਹੋਟਲ ਵਿੱਚ ਜਾ ਕੇ ਖਾਣਾ ਖਾਂਦੇ ਹਾਂ ਅਤੇ ਉੱਥੋਂ ਦੇ ਖਾਣੇ ਦਾ ਅਸੀਂ ਆਨੰਦ ਮਾਣਦੇ ਹਾਂ ਉਹ ਵੀ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ